ਗੱਤਕਾ ਜਿਹੜਾ ਪੰਜਾਬ ਦੇ ਵਿੱਚ ਔਰ ਸਿੱਖੀ ਦੇ ਵਿੱਚ ਬਹੁਤ ਹੀ ਪ੍ਰਚਲਿਤ ਖੇਡ ਹੈ ਜਿਹੜੀ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਔਰ ਉਹ ਜਿਹੜਾ ਉਹਨਾਂ ਤੋਂ ਸ਼ੁਰੂ ਹੋਇਆ ਇਹ ਬਹੁਤ ਹੀ ਸਿੱਖ ਧਰਮ ਦੇ ਵਿੱਚ ਅਹਿਮ ਪ੍ਰੋਜੈਕਟ ਹੈ ਔਰ ਇਹਨੂੰ ਖੇਡਣ ਵਾਸਤੇ ਜਿਹੜਾ ਇੱਕ ਸਿੰਘ ਦਸ ਦਸ ਸਿੰਘਾਂ ਦਾ ਵੀ ਨਾਲ ਮੁਕਾਬਲਾ ਕਰਦਾ ਆ ਔਰ ਇਹਦੇ ਵਿੱਚ ਜਿਹੜੀ ਹੈ ਕਿਰਪਾਨ ਦੇ ਨਾਲ ਜਾਂ ਸੋਟੀ ਦੇ ਨਾਲ ਵੀ ਗਤਕਾ ਖੇਲੀਆਂ ਜਾਂਦੀਆਂ ਔਰ ਕਿਰਪਾਨ ਵਾਲੇ ਦੇ ਹੱਥ ਜਿਸ ਸਾਥੀ ਦਾ ਜਿਹੜਾ ਅ ਖੇਡਣ ਦਾ ਤਰੀਕਾ ਆ ਉਸ ਦੇ ਵਿੱਚ ਇੱਕ ਕਿਰਪਾਨ ਅਤੇ ਦੂਸਰਾ ਢਾਲ ਹੁੰਦੀ ਹੈ ਜਿਹੜਾ ਦੂਸਰੇ ਦਾ ਵਾਰ ਰੋਕਣ ਵਾਸਤੇ ਢਾਲ ਕੰਮ ਕਰਦੀ ਹੈ ਉਹ ਆਮ ਸਿੰਘਾਂ ਦੇ ਪਿੱਠਾਂ ਦੇ ਉੱਤੇ ਸਜਾਈਆਂ ਜਾਂਦੀਆਂ ਜਦੋਂ ਉਹਦੀ ਲੋੜ ਪੈਂਦੀ ਹੈ ਤਾਂ ਉਹਨੂੰ ਖੋਲ੍ਹ ਕੇ ਹੱਥ ਦੇ ਵਿੱਚ ਫੜ ਕੇ ਤਾਲ ਦੇ ਨਾਲ ਕਿਰਪਾਨ ਹੱਥ ਦੇ ਵਿੱਚ ਸੱਜੇ ਹੱਥ ਦੇ ਵਿੱਚ ਕਿਰ ਕਿਰਪਾਨ ਅਤੇ ਖੱਬੇ ਹੱਥ ਦੇ ਵਿੱਚ ਢਾਲ ਜਿਹੜੀ ਹੈ ਉਹ ਖੇਡਣ ਦਾ ਹਿੱਸਾ ਬਣਦੀ ਹੈ ਔਰ ਬਹੁਤ ਹੀ ਪ੍ਰਚਲਤ ਔਰ ਦੂਸਰਾ ਇਹਨੂੰ ਚਲਾਉਣ ਵਾਸਤੇ ਪਿੰਡਾਂ ਦੇ ਵਿੱਚ ਪੰਜ ਪੰਜ ਦਸ ਦਸ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ ਇਹਨੂੰ ਪਿੰਡਾਂ ਦੇ ਵਿੱਚ ਸ਼ੁਰੂ ਕਰਨੀ ਚਾਹੀਦੀ ਹੈ ਇਹ ਦੁਸ਼ਮਣ ਦੇ ਨਾਲ ਵੀ ਲੋਹਾ ਲੈਣ ਵਾਸਤੇ ਬਹੁਤ ਹੀ ਵਧੀਆ ਉਪਰਾਲਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਿੰਘ ਸੱਜਦੇ ਆ ਔਰ ਸਿੰਘ ਖੇਡਦੇ ਆ ਅਤੇ ਇਸੇ ਤਰ੍ਹਾਂ ਜਿਹੜੀਆਂ ਬੀਬੀਆਂ ਵੀ ਜਿਹੜੀਆਂ ਇਹਦੇ ਵਿੱਚ ਹਿੱਸਾ ਲੈ ਸਕਦੀਆਂ ਨੇ ਔਰ ਜਿਹੜਾ ਵੱਧ ਤੋਂ ਵੱਧ ਜਿਹੜਾ ਇਹਦਾ ਫਾਇਦਾ ਜਿਹੜਾ ਲੈ ਸਕਦੇ ਆ ਔਰ ਆਉਣ ਵਾਲੀ ਪੀੜ੍ਹੀਆਂ ਜਿਹੜੀਆਂ ਨਸ਼ੇ ਤੋਂ ਵੀ ਬਚੀਆਂ ਜਾ ਸਕਦੀਆਂ ਹਨ